ਜ਼ਿਆਦਾਤਰ ਅਸੀਂ ਸਾਡੇ ਬਗੀਚੇ ਦੇ ਵਿੱਚ ਪੌਦੇ ਲਗਾਉਣ ਲਈ ਉਹਨਾਂ ਅਤੇ ਉਹਨਾਂ ਨੂੰ ਅਸੀਂ ਸਾਡੇ ਬਗੀਚੇ ਦੇ ਕੁਝ ਜਗ੍ਹਾ ਦੇ ਵਿੱਚ ਤਿਆਰ ਕਰਦੇ ਹਾਂ ਜਿਸ ਦੇ ਵਿੱਚ ਅਸੀਂ ਉਹਨਾਂ ਦੇ ਬੀਜਾਂ ਨੂੰ ਕੁਝ ਕੁ ਦੇਰ ਮਿੱਟੀ ਦੇ ਵਿੱਚ ਬੋ ਕੇ ਉਹਨਾਂ ਦੀ ਸਾਂਭ ਸੰਭਾਲ ਕਰਦੇ ਹਾਂ ਅਤੇ ਬਾਹਰ ਆਉਣ 'ਤੇ ਉਹਨਾਂ ਨੂੰ ਉਨਾਂ ਨੂੰ ਪ੍ਰੋਪਰ ਉਹਨਾਂ ਨੂੰ ਪਾਣੀ ਅਤੇ ਖਾਦ ਵਗੈਰਾ ਦਿੱਤੀ ਜਾਂਦੀ ਹੈ ਜਿਸ ਨਾਲ ਕਿ ਉਹ ਵਧੀਆ ਢੰਗ ਨਾਲ ਉੱਗ ਸਕਣ ਅਤੇ ਕੁਝ ਕੁ ਪੋ ਕੁਝ ਕੁ ਪੌਦੇ ਜੋ ਕਿ ਅਸੀਂ ਵੀ ਸਿੱਧੀ ਬੀਜਾਈ ਨਹੀਂ ਕਰ ਸਕਦੇ ਜਿਵੇਂ ਕਿ ਗੁਲਾਬ ਗੈਂਦਾ ਅਸੀਂ ਉਹਨਾਂ ਨੂੰ ਅਸੀਂ ਸਾਡੇ ਨੇੜੇ ਦੀ ਨਰਸਰੀ ਦੇ ਵਿੱਚੋਂ ਲੈ ਲੈ ਆਉਂਦੇ ਹਾਂ ਅਤੇ ਉਹਨਾਂ ਨੂੰ ਉੱਥੇ ਤੋਂ ਸਿੱਧਾ ਬਗੀਚੇ ਦੇ ਵਿੱਚ ਲਗਾ ਦਿੰਦੇ ਹਾਂ